ਮੈਂ ਸੂਟ ਸਿਲਾਈ ਕਰਦੀ ਹਾਂ ਅਤੇ ਕਈ ਵਾਰ ਕੋਈ ਡਿਜ਼ਾਈਨ ਨਾ ਪਤਾ ਹੋਣ ਕਰਕੇ ਮੈਂ ਯੂਟੀਊਬ 'ਤੇ ਚੈਨਲਾਂ 'ਤੇ ਡਿਜ਼ਾਈਨ ਦੇਖ ਲੈਂਦੀ ਹਾਂ ਸੂਟਾਂ ਦੇ ਅਤੇ ਉੱਥੋਂ ਫਿਰ ਮੈਂ ਸਿ ਸਿਖਲਾਈ ਲੈਂਦੀ ਹਾਂ